ਹੈਲੋ ਸਤਿ ਸ਼੍ਰੀ ਅਕਾਲ ਬੇਟੇ ਹਾਂਜੀ ਅੱਛਾ ਬੇਟਾ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਮਸ਼ਹੂਰ ਜਿਹੜੇ ਫਰੀਡਮ ਫਾਈਟਰ ਪੰਜਾਬ ਦੇ ਉਹ ਹੈਗੇ ਆ ਭਗਤ ਸਿੰਘ ਤੁਸੀਂ ਉਹਨਾਂ ਬਾਰੇ ਲਿਖ ਸਕਦੇ ਹੋ ਕਿਤ ਉਹਨਾਂ ਨੇ ਕਿਵੇਂ ਸੰਘਰਸ਼ ਕੀਤਾ ਕਿਵੇਂ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਆਪਣੀ ਜਾਨ ਗਵਾਈ ਸ਼ਹਾਦਤ ਦਿੱਤੀ ਸੀਗੀ ਉਹਨਾਂ ਬਾਰੇ ਲਿਖ ਸਕਦੇ ਹੋ ਅਤੇ ਉਹਨਾਂ ਦੇ ਸਾਥੀ ਸੁਖਦੇਵ ਬਾਰੇ ਉਹਨਾਂ ਬਾਰੇ ਵੀ ਲਿਖ ਸਕਦੇ ਹੋ ਕਿਵੇਂ ਉਹਨਾਂ ਨੂੰ ਫਾਂਸੀ ਹੋਈ ਸੀ ਕੀ ਕੀ ਉਹਨਾਂ ਨੇ ਝੇਲਿਆ ਸੀ ਤੁਸੀਂ ਇਹ ਸਭ ਬਾਰੇ ਹਾਂਜੀ ਹਾਂਜੀ ਤੁਸੀਂ ਸ਼ੁਰੂਆਤ ਵਿੱਚ ਹੀ ਜੇ ਤੁਸੀਂ ਐਵੇਂ ਕਰਿਓ ਠੀਕ ਹੈ ਤੁਸੀਂ ਸ਼ੁਰੂਆਤ ਵਿੱਚ ਉਹਨਾਂ ਦੇ ਪੂਰੀ ਜੋ ਹੈ ਹਿਸਟਰੀ ਲਿਖ ਦਿਓ ਠੀਕ ਹੈ ਮੁੜ ਕੇ ਜੋ ਵੀ ਉਹਨਾਂ ਨਾਲ ਹੋਇਆ ਉਹ ਸਾਰਾ ਬਾਅਦ 'ਚ ਲਿਖ ਦੇਣਾ ਹਾਂਜੀ ਅਤੇ ਅਸਾਈਨਮੈਂਟ ਨੂੰ ਅਸਾਈਨਮੈਂਟ ਵਿੱਚ ਤੁਸੀਂ ਚਿੱਤਰ ਜ਼ਰੂਰ ਲਗਾਇਓ ਤਾਂ ਕਿ ਉਹ ਇੱਕ ਪ੍ਰਭਾਵਸ਼ਾਲੀ ਪਵੇ ਉਹਨਾਂ 'ਤੇ ਹੁੰ ਫਿਰ ਸਰਦਾਰ ਊਧਮ ਸਿੰਘ ਜੀ ਉਹਨਾਂ ਨੇ ਜੋ ਕਿ ਸਿਰਫ਼ ਛੋਟੀ ਉਮਰ 'ਚ ਉੱਨੀ ਸਾਲਾਂ ਦੀ ਉਮਰ 'ਚ ਹੀ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਉਹ ਬਾਹਰੋਂ ਇੰਗਲੈਂਡ ਤੋਂ ਪੜ੍ਹ ਕੇ ਆਏ ਸੀ ਉਹਨਾਂ ਬਾਰੇ ਸਾਰਾ ਕੁਛ ਤੁਸੀਂ ਦੱਸ ਸਕਦੇ ਹੋ ਉਹਦੇ ਵਿੱਚ ਹਾਂਜੀ ਹਾਂਜੀ ਸ਼ਾਬਾਸ਼ ਬੇੇਟੇ ਬਹੁਤ ਵਧੀਆ ਇਹ ਚੀਜ਼ ਤੁਸੀਂ ਮੈਨੂੰ ਬਹੁਤ ਸੁਣ ਕੇ ਵਧੀਆ ਲੱਗਿਆ ਕਿ ਤੁਸੀਂ ਇਹ ਚੀਜ਼ ਨੂੰ ਵੀ ਮਾਇਨੇ ਰੱਖਦੇ ਹੋ ਨਹੀਂ ਤੁਸੀਂ ਦੇਖ ਕੇ ਬੋਲ ਸਕਦੇ ਹੋ ਜੋ ਤੁਸੀਂ ਚਿੱਤਰ ਲਾਗਾਊਂਗੇ ਉਹ ਬੱਚਿਆਂ ਨੂੰ ਦਿਖਾ ਕੇ ਉਹਨਾਂ ਨੂੰ ਸਮਝਾ ਸਕਦੇ ਹੋ ਹਾਂਜੀ ਹਾਂ ਇਹ ਇਹ ਮੈਂ ਸਾਰੀ ਕਲਾਸ ਸਾਹਮਣੇ ਤੁਹਾਨੂੰ ਦੱਸਾਂਗੀ ਮਤਲਬ ਹਜੇ ਮੈਂ ਬੇਟਾ ਦੱਸ ਨਹੀਂ ਸਕਦੀ ਸਾਰਾ ਕੁਛ ਇੱਦਾਂ ਅਤੇ ਬਾਕੀ ਬੱਚਿਆਂ ਤੁਸੀਂ ਆਪਣੇ ਬਾਕੀਆਂ ਬੱਚਿਆਂ ਨਾਲ ਡਿਸਕਸ ਕਰੋ ਠੀਕ ਆ ਅਤੇ ਜਿਵੇਂ ਉਹ ਹਾਂਜੀ ਹਾਂਜੀ ਹਾਂਜੀ ਅਤੇ ਇਹਦੀ ਜਿਹੜੀ ਡੇਟ ਆ ਇਹਦੀ ਜਿਹੜੀ ਤਾਰੀਖ਼ ਆ ਜਿਸ ਦਿਨ ਤੁਸੀਂ ਇਹਨੂੰ ਜਮ੍ਹਾਂ ਕਰਾਉਣਾ ਆ ਉਹ ਆਪਣੇ ਗਰੁੱਪ 'ਚ ਲਿਖ ਦਿਓ ਇਹ ਦੀ ਤਾਰੀਖ਼ ਪਰਸੋਂ ਦੀ ਆ ਕਿਉਂਕਿ ਕੱਲ੍ਹ ਮੈਂ ਛੁੱਟੀ 'ਤੇ ਹਾਂ ਕੱਲ੍ਹ ਮੈਂ ਆ ਨਹੀਂ ਰਹੀ ਅਤੇ ਅਹ ਜ਼ਰੂਰ ਸੂਚੀ ਦੇ ਦਿਓ ਬੱਚਿਆਂ ਨੂੰ ਠੀਕ ਆ ਚੱਲ ਠੀਕ ਆ ਆਪਾਂ ਕਰਦੇ ਫਿਰ ਠੀਕ ਠੀਕ ਹੈ ਓਕੇ ਧੰਨਵਾਦ